ਸਤਿ ਸ਼੍ਰੀ ਅਕਾਲ ਜੀ ਇਹ ਹਾਂ ਇਹ ਸੱਚ ਹੈ ਕਿ ਮੈਨੂੰ ਫੋਟੋਗ੍ਰਾਫੀ ਕਰਨਾ ਬਹੁਤ ਹੀ ਪਸੰਦ ਹੈ ਮੈਂ ਸ਼ੁਰੂ ਤੋਂ ਹੀ ਛੋਟੇ ਛੋਟੇ ਪ੍ਰੋਗਰਾਮਾਂ ਵਿੱਚ ਫੋਟੋਆਂ ਖਿਚਵਾਉਂਦੀ ਅਤੇ ਖਿੱਚਦੀ ਸੀ ਅਤੇ ਆਪਣੇ ਫਰੈਂਡਾਂ ਨੂੰ ਦੀਆਂ ਜਨਮਦਿਨ ਲੋਹੜੀ ਦੀਵਾਲੀ ਮੇਲੇ ਜ ਹੋਰ ਵੀ ਬਹੁਤ ਸਾਰੇ ਫਕਸਨ 'ਤੇ ਫੋਟੋਗ੍ਰਾਫੀ ਕੀਤੀ ਜਾਂਦੀ ਸੀ ਅਤੇ ਉਸ ਵਿੱਚ ਮੈਨੂੰ ਬਹੁਤ ਹੀ ਪਸੰਦ ਸੀ ਅਤੇ ਮੈਂ ਫੋਟੋਗ੍ਰਾਫੀ ਦੇ ਵਿੱਚ ਅਤੇ ਇੱਕ ਮੈਂ ਸਕੂ ਅੱਜ ਕੱਲ੍ਹ ਸਕੂਲ ਵਿੱਚ ਹੀ ਇਹ ਵਿਸ਼ਾ ਬਣ ਗਿਆ ਹੈ ਫੋਟੋਗ੍ਰਾਫੀ ਦਾ ਉਸ ਵਿੱਚ ਮੈਂ ਫੋਟੋਗ੍ਰਾਫੀ ਵਿਸ਼ਾ ਸਬਜੈਕਟ ਰੱਖਿਆ ਗਿਆ ਅਤੇ ਉਸ ਵਿੱਚ ਸਾਡੇ ਸਕੂਲ ਵਿੱਚ ਕੋਈ ਵੀ ਫੰਕਸ਼ਨ ਹੁੰਦਾ ਤਾਂ ਮੈਂ ਹਰ ਵਾਰ ਫੋਟੋ ਖਿੱਚਦੀ ਖਿੱਚਦੀ ਸੀ ਉਹਨਾਂ ਦੀਆਂ ਅਤੇ ਹਰ ਤਿਉਹਾਰ ਮੌਕੇ ਵੀ ਬਹੁਤ ਸਾਰੀਆਂ ਫੋਟੋਆਂ ਖਿਚਵਾਈਆਂ ਜਾਂਦੀਆਂ ਸਨ ਅਤੇ ਹੁਣ ਮੈਂ ਇੱਕ ਆਪਣਾ ਸਟੂਡੀਓ ਸਟੂਡੀਓ ਖੋਲ੍ਹ ਲਿਆ ਹੈ ਅਤੇ ਉਸ ਵਿੱਚ ਲੋਕਾਂ ਨੂੰ ਅਤੇ ਦੂਰੋਂ ਦੂਰੋਂ ਬਹੁਤ ਸਾਰੇ ਲੋਕਾਂ ਨੂੰ ਉਹ ਫੋਟੋ ਖਿਚਵਾਉਣ ਲਈ ਆਉਂਦੇ ਸਨ ਅਤੇ ਵੀਡੀਓ ਬਣਾਉਣ ਲਈ ਅਤੇ ਵਿਆਹ ਸ਼ਾਦੀਆਂ 'ਤੇ ਵੀ ਮੈਂ ਜਾਂਦੀ ਸੀ ਤਾਂ ਮੇਰੀ ਦਿਕ ਸਟੂਡੀਓ ਬਹੁਤ ਹੀ ਵਧੀਆ ਚਲਦਾ ਸੀ ਅਤੇ ਉਸ ਵਿੱਚ ਮੈਨੂੰ ਬਹੁਤ ਹੀ ਵਧੀਆ ਚੱਲਦਾ ਸੀ ਅਤੇ ਇਹ ਫੋਟੋਗ੍ਰਾਫੀ ਕ ਕਰਨਾ ਮੇਰਾ ਬਚਪਨ ਤੋਂ ਹੀ ਸੌਕ ਸੀ ਜੋ ਕਿ ਅੱਜ ਪੂਰਾ ਹੋ ਗਿਆ ਹੈ ਅਤੇ ਮੈਂ ਬਹੁਤ ਹੀ ਵੱਡੀ ਫੋਟੋਗ੍ਰਾਫੀ ਇੱਕ ਵੀਡੀਓ ਬਣ ਗਿਆ ਅਤੇ ਅੱਜ ਕੱਲ੍ਹ ਪਿੰਡਾਂ ਵਿੱਚ ਬਹੁਤ ਹੀ ਬਹੁਤ ਹੀ ਬਹੁਤ ਹੀ ਜ਼ਿਆਦਾ ਪ੍ਰਚਲਿਤ ਪ੍ਰਚਲਿਤ ਹੈ ਕਿ ਬੀ ਫੋਟੋਗ੍ਰਾਫਿਕ ਤੋਂ ਬਿਨਾਂ ਕੋਈ ਵੀ ਫੰਕਸ਼ਨ ਅਟੈਂਡ ਨਹੀਂ ਕੀਤਾ ਜਾਂਦਾ ਇਸ ਤੋਂ ਬਿਨਾਂ ਬੋਰਿੰਗ ਪਾਰਟੀਆਂ ਦੀ ਬੋਰਿੰਗ ਲੱਗਦੀਆਂ ਹਨ ਫੋਟੋਗ੍ਰਾਫੀ ਤੋਂ ਬਿਨਾਂ ਨਾ ਤਾਂ ਕੋਈ ਪਾਰਟੀ ਨਾ ਕੋਈ ਵਿਆਹ ਸ਼ਾਦੀ ਵਧੀਆ ਲੱਗਦੀ ਹੈ ਤਾਂ ਕਿ ਲੋਕ ਵੱਧ ਤੋਂ ਵੱਧ ਫੋਟੋਆਂ ਖਿਚਵਾਉਂਦੇ ਸਨ